ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਬਹੁਤ ਹੀ ਸਾਰੇ ਮੁੱਖ ਮਨੋਰੰਜਨ ਅਤੇ ਨਾਈਟ ਲਾਈਫ ਜ਼ਿਲ੍ਹੇ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਅਮਿਊਜ਼ਮੈਂਟ ਪਾਰਕ ਅ ਜਿਹਦੇ ਵਿੱਚ ਲੋਕ ਜਾ ਕੇ ਵੱਖ ਵੱਖ ਜਗ੍ਹਾ 'ਤੇ ਦੇਖਦੇ ਹਨ ਅਤੇ ਉਨ੍ਹਾਂ ਬਾਰੇ ਪੜ੍ਹਦੇ ਹਨ ਹੋਰ ਵੀ ਬਹੁਤ ਸਾਰੀਆਂ ਮਨੋਰੰਜਨ ਲਈ ਜਗ੍ਹਾਵਾਂ ਹਨ ਜਿਵੇਂ ਕਿ ਜ਼ੂ ਜਿੱਥੇ ਲੋਕ ਜਾ ਕੇ ਜਾਨਵਰਾਂ ਦੇ ਨੂੰ ਦੇਖਦੇ ਹਨ ਆਪਣੇ ਮਨਪਸੰਦ ਜਾਨਵਰਾਂ ਨੂੰ ਅਤੇ ਉਸ ਜਾਨਵਰਾਂ ਨੂੰ ਦੇਖ ਕੇ ਉਨ੍ਹਾਂ ਬਾਰੇ ਬਹੁਤ ਹੀ ਵਧੀਆ ਤਰ੍ਹਾਂ ਸਿੱਖਦੇ ਹਨ ਹੋਰ ਵੀ ਬਹੁਤ ਸਾਰੀਆਂ ਮਨੋਰੰਜਨ ਲਈ ਜਗ੍ਹਾਵਾਂ ਹਨ ਜਿਵੇਂ ਕਿ ਤਿਉਹਾਰ ਸਭ ਲੋਕ ਤਿਉਹਾਰ 'ਤੇ ਇਕੱਠੇ ਹੁੰਦੇ ਹਨ ਅਤੇ ਤਿਉਹਾਰਾਂ 'ਤੇ ਮਿਲਦੇ ਹਨ ਤਿਉਹਾਰ 'ਤੇ ਮਿਲਣ 'ਤੇ ਉਹ ਢਾਬੇ ਵਿੱਚ ਜਾਂਦੇ ਹਨ ਅਤੇ ਉੱਥੋਂ ਰੋਟੀ ਪਾਣੀ ਖਾਂਦੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਸਭ ਦੀ ਬਹੁਤ ਹੀ ਜ਼ਿਆਦਾ ਤੰਗ ਵਾਲੀ ਜ਼ਿੰਦਗੀ ਹੈ ਜਿਹਦੇ ਕਾਰਨ ਜਲਦੀ ਕੋਈ ਮਿਲ ਨਹੀਂ ਸਕਦਾ ਪਰ ਤਿਉਹਾਰ 'ਤੇ ਹੀ ਸਭ ਇਕੱਠੇ ਹੁੰਦੇ ਹਨ ਅਤੇ ਉਹ ਇੱਕ ਦੂਜੇ ਨੂੰ ਮਿਲਦੇ ਹਨ ਅਤੇ ਇੱਕ ਦੂਜੇ ਦੇ ਨਾਲ ਆਪਣਾ ਵਕਤ ਗੁਜ਼ਾਰਦੇ ਹਨ ਇਹ ਵਕਤ ਉਹ ਢਾਬੇ ਵਿੱਚ ਜਾ ਕੇ ਉੱਥੋਂ ਰੋਟੀ ਪਾਣੀ ਖਾ ਕੇ ਇਵੇਂ ਇਵੇਂ ਵੀ ਗੁਜ਼ਾਰ ਲੈਂਦੇ ਹਨ ਅਤੇ ਆਪਣਾ ਦਿਲ ਨੂੰ ਹੋਲਾ ਕਰਕੇ ਆਪਣਾ ਗੱਲਾਂ ਬਾਤਾਂ ਕਰਕੇ ਵੀ ਗੁਜ਼ਾਰ ਲੈਂਦੇ ਹਨ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮਨੋਰੰਜਨ ਲਈ ਜਗ੍ਹਾਵਾਂ ਹਨ ਜਿਵੇਂ ਕਿ ਨਾਈਟ ਕਲੱਬ ਅੱਜ ਅੱਜ ਕੱਲ੍ਹ ਜਿਵੇਂ ਲੋਕ ਕੁੜੀ ਮੁੰਡੇ ਅਕਸਰ ਰਾਤ ਨੂੰ ਨਾਈਟ ਕਲੱਬਸ ਵਿੱਚ ਜਾ ਕੇ ਉੱਥੋਂ ਦੇ ਨੂੰ ਵਧੀਆ ਤਰ੍ਹਾਂ ਇੰਜੋਏ ਕਰਦੇ ਹਨ ਅਤੇ ਨੱਚਦੇ ਹਨ ਅਤੇ ਬਹੁਤ ਹੋਰ ਵੀ ਕੁਝ ਕਰਦੇ ਹਨ ਐਵੇਂ ਹੀ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮਨੋਰੰਜਨ ਲਈ ਜਗ੍ਹਾਵਾਂ ਹਨ ਧੰਨਵਾਦ ਜੀ